ਅੱਜ ਦਾ ਯੁੱਗ ਟਕਨੋਲਜੀ ਦਾ ਯੁੱਗ ਹੈ ਇਸ ਲਈ ਅੱਜ ਨਵੀਆਂ ਨਵੀਆਂ ਟਕਨੋਲਜੀਆਂ ਆ ਗਈਆਂ ਹਨ ਕੰਪਿਊਟਰ ਮੋਬਾਈਲ ਫੋਨ ਅਤੇ ਲੈਪਟੋਪ ਪਰ ਇਹਨਾਂ ਵਿੱਚੋਂ ਮੋਬਾਈਲ ਫੋਨ ਤਾਂ ਇੰਟਰਨੈੱਟ ਬਹੁਤ ਜ਼ਿਆਦਾ ਤੇਜੀ ਨਾਲ਼ ਵੱਧ ਰਹੇ ਹਨ ਪਰ ਸਭ ਤੋਂ ਜ਼ਿਆਦਾ ਅਸੀਂ ਮੋਬਾਈਲ ਫੋਨ ਅਤੇ ਇੰਟਰਨੈੱਟ ਤੋਂ ਬਿਨਾਂ ਨਹੀਂ ਰਹਿ ਸਕਦੇ ਮੰਨ ਲਓ ਜੇ ਕਿਸੇ ਵੀ ਦਿਨ ਇੰਟਰਨੈੱਟ ਬੰਦ ਹੋ ਜਾਵੇ ਤਾਂ ਇਸ ਤੋਂ ਬਾ ਨਾਲ਼ ਸਾਰੀ ਦੁਨੀਆਂ ਵਿੱਚ ਬਹੁਤ ਜ਼ਿਆਦਾ ਹਲਚਲ ਮੱਚ ਜਾਂਦੀ ਹੈ ਜਿਸ ਨਾਲ਼ ਇਸ ਟਕਨੋਲਜੀ ਦੇ ਨਾਲ ਬੈਂਕਾਂ ਦਾ ਅਤੇ ਬਹੁਤ ਸਾਰੇ ਹੋਰ ਵੀ ਕੰਮ ਜੁੜੇ ਹੋਏ ਹਨ ਉਸੇ ਤਰ੍ਹਾਂ ਹੀ ਇੱਕ ਮੋਬਾਈਲ ਫੋਨ ਹੈ ਇਸ ਦੇ ਨਾਲ਼ ਵੀ ਇਸ ਟਕਨੋਲੋਜੀ ਦੇ ਨਾਲ਼ ਵੀ ਬਹੁਤ ਸਾਰੇ ਕੰਮ ਜੁੜੇ ਹੋਏ ਹਨ ਇਸ ਤੋਂ ਬਿਨਾਂ ਵੀ ਅਸੀਂ ਨਹੀਂ ਰਹਿ ਸਕਦੇ ਇਸ ਦੇ ਨਾਲ਼ ਅਸੀਂ ਕਾਰ ਵਿਹਾਰ ਆਪਣੀ ਵਪਾਰ ਵਿੱਚ ਬਹੁਤ ਵਾਧਾ ਵੀ ਕਰਦੇ ਹਾਂ ਇਸ ਦੇ ਬਹੁਤ ਸਾਰੇ ਲਾਭ ਵੀ ਹਨ ਅਤੇ ਹਾਨੀਆਂ ਵੀ ਹਨ ਮੋਬਾਈਲ ਦੇ ਨਾਲ ਸਾਨੂੰ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ਹੈ ਉਸੇ ਤਰ੍ਹਾਂ ਹੀ ਇੰਟਰਨੈੱਟ ਤੋਂ ਅਸੀਂ ਬਹੁਤ ਕੁਛ ਵਧੀਆ ਵੀ ਸਿੱਖ ਸਕਦੇ ਹਾਂ ਪਰ ਅੱਜ ਦੇ ਯੁੱਗ ਵਿੱਚ ਦੁਨੀਆਂ ਕੁਛ ਇਸ ਟਕਨੋਲਜੀ ਦਾ ਗ਼ਲਤ ਫਾਇਦਾ ਵੀ ਚੁੱਕ ਰਹੀ ਹੈ ਇਸ ਟਕਨੋਲਜੀ ਦੇ ਨਾਲ਼ ਬਹੁਤ ਬਹੁਤ ਵੱਡੇ ਗਲਤ ਕੰਮ ਵੀ ਹੋ ਰਹੇ ਹਨ ਜਿਸ ਕਾਰਨ ਇਸ ਟਕਨੋਲਜੀ ਨੂੰ ਅਸੀਂ ਬਹੁਤ ਵਧੀਆ ਵੀ ਕਹਿ ਸਕਦੇ ਹਾਂ ਅਤੇ ਬਹੁਤ ਮਾੜਾ ਨਹੀਂ ਕਹਿ ਸਕਦੇ ਪਰ ਮੋਬਾਈਲ ਫੋਨ ਦੇ ਨਾਲ਼ ਸਾਡਾ ਅੱਜ ਦਾ ਯੁੱਗ ਬਹੁਤ ਜੁੜਿਆ ਹੋਇਆ ਹੈ ਇਸ ਤੋਂ ਫੋਨ ਬਿਨਾਂ ਜੇਕਰ ਸਾਡੇ ਕੋਲ ਨਾ ਹੋਵੇ ਤਾਂ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ ਇਸ ਤੋਂ ਬਿਨਾਂ ਅਸੀਂ ਬਿਲਕੁਲ ਹੀ ਅਣਜਾਣ ਬਣ ਜਾਂਦੇ ਹਾਂ ਕਿ ਜਿਵੇਂ ਸਾਨੂੰ ਕੁਝ ਵੀ ਨਹੀਂ ਆਉਂਦਾ ਪਰ ਇੰਟਰਨੈੱਟ ਤੋਂ ਬਿਨਾਂ ਵੀ ਅਸੀਂ ਨਹੀਂ ਰਹਿ ਸਕਦੇ ਇਸ ਦੇ ਨਾਲ਼ ਵੀ ਅਸੀਂ ਬਹੁਤ ਕੁਛ ਸਿੱਖਦੇ ਹਾਂ